ਹਾਂਜੀ ਵੀਰੇ ਮੈਂ ਨਾ ਤੁਹਾਡੇ ਕੰਪਨੀ ਤੋਂ ਟੈਕਸੀ ਬੁੱਕ ਕਰੀ ਤੀ ਠੀਕ ਹੈ ਅਤੇ ਮੈਂ ਪਹਿਲਾਂ ਹੀ ਬਹੁਤ ਕਾਹਲੀ 'ਚ ਸੀਗਾ ਠੀਕ ਹੈ ਉੱਪਰ ਤੋਂ ਤੁਸੀਂ ਰੇਟ ਵੀ ਬਹੁਤ ਜ਼ਿਆਦਾ ਲਾਇਆ ਅਤੇ ਜਿਹੜਾ ਤੁਸੀਂ ਡਰਾਈਵਰ ਭੇਜਿਆ ਉਹਦਾ ਸੁਭਾਅ ਸਹੀ ਨਹੀਂ ਸੀ ਠੀਕ ਜੀ ਅਤੇ ਗੱਡੀ ਵੀ ਬਹੁਤ ਜ਼ਿਆਦਾ ਹਾਲਤ ਖਰਾਬ ਸੀ ਗੱਡੀ ਦੀ ਸੀਟਾਂ ਪਾਟੀਆਂ ਵੀ ਸੀ ਸਗੋਂ ਸ ਅ ਰਸਤੇ ਵਿੱਚ ਜਾਂਦੀ ਹੋਈ ਪੈਂਚਰ ਹੋ ਗਈ ਜਿਸ ਕਾਰਨ ਮੈਂ ਬਹੁਤ ਜ਼ਿਆਦਾ ਲੇਟ ਹੋਇਆ ਠੀਕ ਹੈ